ਸਤਿ ਸ਼੍ਰੀ ਅਕਾਲ ਕੌਣ ਪਕਸ਼ੀ ਜਿਹੜੀ ਮੇਰੀ ਕਲਾਸ 'ਚ ਪੜ੍ਹਦੀ ਉਹਦੇ ਮੰਮਾ ਬੋਲੋ ਬੋਲੋ ਕਿੰਨੀਆਂ ਛੁੱਟੀਆਂ ਦਸ ਦਿਨ ਮੈਡਮ ਜ਼ਿਆਦਾ ਨਹੀਂ ਥੋੜ੍ਹਾ ਘੱਟ ਵੱਧ ਕਰ ਲਓ ਠੀਕ ਆ ਠੀਕ ਆ ਅਤੇ ਦਸ ਦਿਨ ਬਾਅਦ ਆਜੂਗੀ ਨਾ ਹੋਰ ਲੇਟ ਤਾਂ ਨਹੀਂ ਕਰੂਗੀ ਠੀਕ ਹੈ ਠੀਕ ਹੈ ਅਤੇ ਦੱਸੋ ਮੈਂ ਕੀ ਕਰਾਂ ਕੀ ਸੇਵਾ ਠੀਕ ਹੈ ਮੈਂ ਕਰ ਦੂੰਗਾ ਅਤੇ ਇੱਕ ਵਾਰੀ ਉਹਦਾ ਰੋਲ ਨੰਬਰ ਵਗੈਰਾ ਦੱਸ ਦਿਓ ਕਿੰਨਾ ਠੀਕ ਹੈ ਮੈਂ ਕਰਾ ਦੂੰਗਾ ਹਾਂ ਠੀਕ ਆ ਠੀਕ ਆ ਓਕੇ ਓਕੇ ਬਾਏ